ਵੀਰ ਜੀ ਸਤਿ ਸ਼੍ਰੀ ਅਕਾਲ ਹਾਂ ਵੀਰੇ ਕੀ ਹਾਲ ਚਾਲ ਹੈ ਵੀਰ ਜੀ ਯਾਰ ਮੈਂ ਨਾ ਕਿਸੇ ਖਾਤੇ ਵਿੱਚ ਯਾਰ ਮੇਰਾ ਘਰ ਦਾ ਪਤਾ ਨਾ ਥੋੜ੍ਹਾ ਗਲਤ ਲਿਖਿਆ ਗਿਆ ਤਾਂ ਮੈਂ ਉਹਨੂੰ ਕਿਵੇਂ ਠੀਕ ਕਰ ਸਕਦਾ ਯਾਰ ਹਾਂ ਥੋੜ੍ਹੀ ਗਲਤੀ ਹੈ ਤਾਂ ਉਹਨੂੰ ਠੀਕ ਕਰਨਾ ਕਿਵੇਂ ਠੀਕ ਕਰ ਸਕਦੇ

ਨਹੀਂ ਥੋੜ੍ਹਾ ਘਰਦਾ ਪਤਾ ਹੀ ਗਲਤ ਲਿਖਿਆ ਗਿਆ ਹਾਂ ਪਿੰਡ ਦਾ ਨਾਂ ਗਲਤ ਹੈ ਅਤੇ ਗਲੀ ਨੰਬਰ ਗਲਤ ਏ ਹਾਂਜੀ ਵੀਰ ਇਹਨੂੰ ਅਪਡੇਟ ਕਿਵੇਂ ਕਰ ਸਕਦਾ ਅਪਡੇਟ ਕਰਨ ਵਾਸਤੇ ਬੜਾ ਥੋੜ੍ਹਾ ਜਾ ਤੁਹਾਨੂੰ ਤਰੀਕੇ ਨਾਲ ਸਮਝਾ ਦਿਓ ਸਟੈਪ ਬਾਏ ਸਟੈਪ ਸਮਝਾ ਦਿਓ ਕਿ ਉਹਨੂੰ ਮੈਂ ਕਿੱਦਾਂ ਠੀਕ ਕਰਨਾ ਹਾਂਜੀ ਠੀਕ ਹੈ ਜੀ ਨਹੀਂ ਬਸ ਛੋਟੀ ਜਿਹੀ ਗਲਤੀ ਹੈ ਜ਼ਿਆਦਾ ਵੱਡੀ ਨਹੀਂ ਐਡਰੈਸ 'ਤੇ ਗਲੀ ਨੰਬਰ ਗਲਤ ਲਿਖਿਆ ਗਿਆ ਬਸ ਹੋਰ ਕੁਛ ਨਹੀਂ ਜੀ ਮੈਂ ਬੈਂਕ ਮੁਲਾਜ਼ਮ ਕੋਲ ਗਿਆ ਸੀ ਅਤੇ ਉਹ ਕਹਿੰਦੇ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਕੋਈ ਚੱਕਰ ਨੀਗਾ ਹਾਂਜੀ ਜੀ ਹਾਂਜੀ ਵੀਰੇ ਘਰ ਦਾ ਡਰੈਸ ਅਤੇ ਗਲੀ ਨੰਬਰ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਤੂੰ ਮੈਨੂੰ ਜਾਣਕਾਰੀ ਦਿੱਤੀ ਮਿਹਰਬਾਨੀ